ਦੋ ਜਨਵਰੀ ਦੋ ਹਜ਼ਾਰ ਦਸ ਪੰਜ ਅਕਤੂਬਰ ਦੋ ਹਜ਼ਾਰ ਵੀਹ ਪੱਚੀ ਦਸੰਬਰ ਦੋ ਹਜ਼ਾਰ ਪੱਚੀ ਪੰਦਰਾਂ ਮਈ ਦੋ ਹਜ਼ਾਰ ਅਠਾਰਾਂ ਦਸ ਫਰਵਰੀ ਦੋ ਹਜ਼ਾਰ ਉੱਨੀ